ਹੈਲੋ ਗੁਡ ਮੋਰਨਿੰਗ ਸਰ ਸਰ ਮੈਨੇ ਨਾ ਕੈਬ ਬੁੱਕ ਕਰਵਾਉਣੀ ਸੀਗੀ ਮੈਂ ਨਮਨ ਜਿੰਦਲ ਭਿੱਖੀ ਤੋਂ ਬੋਲ ਰਿਹਾਂ ਸਰ ਮੈਨੇ ਅਤੇ ਮੇਰੀ ਮਾਤਾ ਜੀ ਨੇ ਆਪਣੇ ਜੱਦੀ ਪਿੰਡ ਜਾਣਾ ਅਤੇ ਇੱਕ ਮੇਰੇ ਦੋਸਤ ਨੇ ਹਾਂਜੀ ਜੱਦੀ ਪਿੰਡ ਸਰ ਸਾਡਾ ਜੀਂਦ ਹੈ ਹਾਂਜੀ ਸਰ ਸਾਨੂੰ ਭਿੱਖੀ ਤੋਂ ਜੀਂਦ ਜਾਣਾ ਹੈਗਾ ਹਾਂਜੀ ਸਰ ਅਤੇ ਸਰ ਮੈਨੇ ਕੈਬ ਬੁੱਕ ਕਰਵਾਉਣੀ ਸੀਗੀ ਸਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਹਾਡੇ ਕੋਲ ਕਿਹੜੇ ਕਿਹੜੇ ਪ੍ਰਕਾਰ ਦੀ ਕਾਰਾਂ ਨੇ ਗੀਆਂ ਅਤੇ ਉਹਨਾਂ ਦੀ ਐਵਰੇਜ ਕੀ ਹੈਗੀ ਠੀਕ ਹੈ ਸਰ ਠੀਕ ਹੈ ਅਤੇ ਸਰ ਵੀ ਤੁਸੀਂ ਕਿਲੋਮੀਟਰ ਦੇ ਹਿਸਾਬ ਨਾਲ ਸਾਡੇ ਤੋਂ ਪੈਸੇ ਲਵੋਂਗੇ ਕਿ ਟੂਲ ਟੈਕਸ ਤੁਸੀਂ ਤੁਹਾਡਾ ਆਪਣਾ ਹੋਵੇਗਾ ਕੀਮਤ ਕਿੰਨੀ ਸਾਰੀ ਕੀਮਤ ਹਾਂਜੀ ਸਰ ਹਾਂਜੀ ਸਰ ਸਰ ਜੋ ਡਰਾਈਵਰ ਹੈ ਬਸ ਇਸ ਗੱਲ ਦਾ ਧਿਆਨ ਰੱਖਿਓ ਤੁਸੀਂ ਵੀ ਜੋ ਡਰਾਈਵਰ ਹੈਗਾ ਉਹ ਡਰਿੰਕ ਨਾ ਕਰਦਾ ਹੋਵੇ ਸਾਨੂੰ ਵਧੀਆ ਫੈਸਲਿਟੀ ਦੇਵੇ ਹਾਂਜੀ ਸਰ ਹਾਂਜੀ ਸਰ ਹਾਂਜੀ ਸਰ ਸਰ ਭਿੱਖੀ ਤੋਂ ਹੀ ਜਾਵਾਂਗੇ ਹਾਂਜੀ ਜੀਂਦ ਜਾਣਾ ਸਰ ਸਾਡਾ ਜੱਦੀ ਪਿੰਡ ਜੀਂਦ ਹੈ ਮੈਂ ਜਾਊਂ ਮੇਰੀ ਮਾਤਾ ਜੀ ਜਾਣਗੇ ਅਤੇ ਮੇਰਾ ਦੋਸਤ ਜਾਵੇਗਾ ਹਾਂਜੀ ਸਰ ਹਾਂਜੀ ਸਰ ਸਰ ਬਸ ਫੈਸਲਿਟੀ ਦਾ ਜ਼ਿਆਦਾ ਧਿਆਨ ਰੱਖਿਓ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆਂ ਗਾ ਵੀ ਡਰਾਈਵਰ ਡਰਿੰਕ ਨਾ ਕਰਦਾ ਹੋਵੇ ਵੀ ਸਾਨੂੰ ਵਧੀਆ ਫੈਸਿਲਿਟੀ ਦੇਵੇ ਰੂਡਲੀ ਬਿਹੇਵ ਨਾ ਕਰੇ ਸਾਡੇ ਨਾਲ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਸਰ ਹਾਂਜੀ ਹਾਂਜੀ ਸਰ ਕੋਈ ਗੱਲ ਨਹੀਂ ਹੈਗੀ ਮੈਂ ਤੁਹਾਨੂੰ ਇਸ ਨੰਬਰ 'ਤੇ ਕਾਲ ਕਰ ਦੂੰਗਾ ਅਤੇ ਤੁਹਾਨੂੰ ਦੱਸ ਦੂੰਗਾ ਵੀ ਅਸੀਂ ਕਿੰਨੀ ਤਾਰੀਖ ਨੂੰ ਕਿੰਨੇ ਵਜੇ ਜਾਣਾ ਹੈ ਗਾ ਠੀਕ ਹੈ ਸਰ ਹਾਂਜੀ ਸਰ ਓਕੇ ਸਰ ਥੈਂਕ ਯੂ ਸਰ ਓਕੇ